ਮੇਰੀ ਡਰਾਇੰਗ ਵਿੱਚ ਪ੍ਰੋਜੈਕਟ ਵਿੱਚ ਕਦੀ ਕੋਈ ਆਲੋਚਨਾ ਕਰਦਾ ਹੈ ਜਾਂ ਫੀਡਬੈਕ ਗਲਤ ਦਿੰਦਾ ਹੈ ਤਾਂ ਮੈਂ ਆਪਣੀ ਡਰਾਇੰਗ ਵਿੱਚ ਆਲ ਉਡ ਕੁਝ ਉਸ ਤੋਂ ਅਲੱਗ ਕਰਨ ਦੀ ਕੋਸ਼ਿਸ਼ ਕਰਦੀ ਹਾਂ ਆਪਣੀ ਗਲਤੀਆਂ ਨੂੰ ਸੁਦੌਰਨ ਸੁਧਾਰਦੀ ਹਾਂ ਤਾਂ ਕਿ ਮੈਨੂੰ ਉਸ ਡਰਾਇੰਗ ਵਿੱਚ ਅਗਲੀ ਵਾਰ ਕੋਈ ਆਲੋਚਨਾ ਨਾ ਕਰ ਸਕੇ ਉਸ ਤੁਹਾਡੀ ਅਲਗ ਕਰਨ ਦੀ ਬਿਲਕੁਲ ਕੋਸ਼ਿਸ਼ ਕਰਦੀ ਹਾਂ ਅਗਰ ਕੋਈ ਡਰਾਇੰਗ ਵਿੱਚ ਆਪਣੀ ਆਲੋਚਨਾ ਕਰਦਾ ਹੈ ਤਾਂ ਸਾਨੂੰ ਉਸ ਤੋਂ ਬੁਰਾ ਨਾ ਮੰਨ ਕੇ ਉਸਨੂੰ ਸੁਧਾਰ ਕੇ ਵਧੀਆ ਬਣਾਉਣਾ ਚਾਹੀਦਾ ਹੈ ਤਾਂ ਤਾਂ ਕਿ ਅਗਲੀ ਵਾਰ ਸਾਨੂੰ ਉਸ ਡਰਾਈ ਪ੍ਰੋਜੈਕਟ ਵਿੱਚ ਫੀਡਬੈਕ ਵਧੀਆ ਮਿਲੇ